ਮੈਂ ਸਿੱਖ ਧਰਮ ਨਾਲ ਸੰਬੰਧਿਤ ਆਂਗੀ ਅਤੇ ਸਾਡੇ ਧਰਮ ਦੇ ਵਿੱਚ ਜਿਹੜਾ ਦੂਜੇ ਧਰਮਾਂ ਦੇ ਲੋਕਾਂ ਨਾਲ ਵੀ ਮਿਲ ਜੁਲ ਕੇ ਰਹਿਣ ਦਾ ਇੱਕ ਸੰਦੇਸ਼ ਦਿੱਤਾ ਗਿਆ ਆ ਗਾ ਸਾਡੇ ਗੁਰੂਆਂ ਨੇ ਦੂਜੇ ਧਰਮਾਂ ਦੇ ਜਿਹੜੇ ਲੋਕ ਸੀਗੇ ਉਹਨਾਂ ਨਾਲ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ ਸੀਗਾ ਚਾਹੇ ਗੁਰੂ ਤੇਗ ਬਹਾਦਰ ਜੀ ਸੀਗੇ ਜਿਨ੍ਹਾਂ ਨੇ ਕਸ਼ਮੀਰੀ ਲੋਕਾਂ ਦੇ ਲਈ ਜਿਹੜਾ ਆਪਣਾ ਸਿਰ ਕਲਮ ਕਰਾ ਦਿੱਤਾ ਸੀਗਾ ਅਤੇ ਇਸੇ ਤਰੀਕੇ ਦੇ ਨਾਲ ਮਤਲਬ ਮੈਂ ਲਗਾਤਾਰ ਹਰ ਰੋਜ਼ ਮੰਦਰ ਮਸਜਿਦ ਹਰ ਅਲੱਗ ਅਲੱਗ ਜਗ੍ਹਾ 'ਤੇ ਜਾਂਦੀ ਐਂਗੀ ਅਤੇ ਇਸ ਤਰੀਕੇ ਨਾਲ ਜਿਹੜੇ ਸਾਡੇ ਧਰਮਾਂ ਆਂਗਾ ਉਹਨੇ ਦੂਜੇ ਲੋਕਾਂ ਦੇ ਨਾਲ ਵੀ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ ਹੋਇਆ